ਜਦੋਂ ਅਸੀਂ ਇੱਕ ਯਾਤਰੀ ਬੱਸ ਬਾਰੇ ਸੋਚਦੇ ਹਾਂ ਤਾਂ ਸਭ ਤੋਂ ਪਹਿਲੇ ਸਾਡੇ ਦਿਮਾਗ ਵਿੱਚ ਆਉਂਦਾ ਹੈ ਡਰਾਈਵਰ ਦੀ ਸੀਟ ਡਰਾਈਵਰ ਸਾਹਮਣੇ ਬੈਠਾ ਹੁੰਦਾ ਸਟੇਰਿੰਗ ਵੀਲ ਅਤੇ ਕੇ ਕੰਟਰੋਲਸ ਦੇ ਨਾਲ ਡਰਾਈਵਰ ਦੀ ਸੀਟ ਤੋਂ ਪੂਰੀ ਸੜਕ ਸਾਫ ਦਿਖਾਈ ਦਿੰਦੀ ਹੈ ਜੋ ਕਿ ਸੁਰੱਖਿਅਤ ਸਫਰ ਲਈ ਬਹੁਤ ਜ਼ਰੂਰੀ ਹੈ ਬੱਸ ਦੇ ਉੱਪਰ ਇੱਕ ਸਟੋਰੇਜ ਕੈਰੀਅਰ ਵੀ ਹੁੰਦਾ ਹੈ ਜਿੱਥੇ ਯਾਤਰੀ ਆਪਣਾ ਸਮਾਨ ਰੱਖਦੇ ਹਨ ਇਹ ਕੈਰੀਅਰ ਬਹੁਤ ਵੱਡਾ ਹੁੰਦਾ ਹੈ ਜਿਸ ਵਿੱਚ ਬਹੁਤ ਸਾਰਾ ਸਮਾਨ ਆ ਸਕਦਾ ਬੱਸ ਵਿੱਚ ਵੱਡੀਆਂ ਵੱਡੀਆਂ ਵਿੰਡੋਜ ਹੁੰਦੀਆਂ ਹਨ ਜਿਹਨਾਂ ਤੋਂ ਬਾਹਰ ਦਾ ਨਜ਼ਾਰਾ ਦੇਖਣ ਦਾ ਮਜ਼ਾ ਆਉਂਦਾ ਹੈ ਬੱਸ ਦੀਆਂ ਸੀਟਾਂ ਆਰਾਮਦਾਇਕ ਹੁੰਦੀਆਂ ਹਨ ਜਿਸ ਨਾਲ ਲੰਬੇ ਸਫਰ ਦਾ ਵੀ ਆਸਾਨ ਹੋ ਜਾਂਦੇ ਹਨ ਅੱਜ ਕੱਲ੍ਹ ਜ਼ਿਆਦਾਤਰ ਬੱਸਾਂ ਡੀਜ਼ਲ 'ਤੇ ਚੱਲਦੀਆਂ ਹਨ ਜੋ ਕਿ ਇੱਕ ਬਹੁਤ ਆਮ ਗੱਲ ਹੈ ਮੈਂ ਬੱਸ ਦੁਆਰਾ ਬਹੁਤ ਸਾਰੀਆਂ ਥਾਵਾਂ 'ਤੇ ਯਾਤਰਾ ਕੀਤੀ ਹੈ ਮੈਨੂੰ ਯਾਦ ਹੈ ਮੈਂ ਇੱਕ ਵਾਰ ਚੰਡੀਗੜ੍ਹ ਤੋਂ ਦਿੱਲੀ ਬੱਸ ਵਿੱਚ ਗਈ ਸੀ ਇਹ ਸਫਰ ਬਹੁਤ ਮਜ਼ੇਦਾਰ ਸੀ ਕਿਉਂਕਿ ਮੈਂ ਰਸਤੇ ਵਿੱਚ ਬਹੁਤ ਸਾਰੇ ਸੁੰਦਰ ਨਜ਼ਾਰੇ ਦੇਖੇ ਮੈਂ ਬਹੁਤ ਸਾਰੀਆਂ ਥਾਵਾਂ 'ਤੇ ਯਾਤਰਾ ਕੀਤੀ ਹੈ ਬੱਸ ਦੇ ਵਿੱਚ ਜਿਵੇਂ ਕਿ ਪਹਾੜੀ ਇਲਾਕੇ ਹੋ ਗਏ ਜਾਂ ਫਿਰ ਪੰਜਾਬ ਦੇ ਕੁਛ ਪਿੰਡਾਂ ਦੇ ਵਿੱਚ ਵੀ ਹਰ ਸਫਰ ਦਾ ਇੱਕ ਆਪਣਾ ਅਲੱਗ ਅਨੁਭਵ ਹੁੰਦਾ ਹੈ ਬੱਸ ਵਿੱਚ ਸਫਰ ਕਰਨਾ ਇੱਕ ਵੱਖਰਾ ਹੀ ਅਹਿਸਾਸ ਹੁੰਦਾ ਹੈ ਜਿੱਥੇ ਤੁਸੀਂ ਆਪਣੇ ਆਸੇ ਪਾਸੇ ਦੀ ਸੁੰਦਰਤਾ ਦੇਖ ਸਕਦੇ ਹੋ ਨਵੇਂ ਨਵੇਂ ਲੋਕਾਂ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਉਹਨਾਂ ਨੂੰ ਮਿਲਦੇ ਹੋ